ਭੰਗੜੇ ਦੀ ਮਹੱਤਤਾ ਪੰਜਾਬ ਦਾ ਪ੍ਰਮੁੱਖ ਉਹ ਹੈ ਸਰੋਤ ਹੈਗਾ ਭੰਗੜੇ ਤੋਂ ਬਿਨਾ ਕੋਈ ਵੀ ਵਿਆਹ ਸ਼ਾਦੀ ਨਹੀਂ ਜੱਚਦੀ ਭੰਗੜੇ ਦੇ ਵਿੱਚ ਲੋਕ ਖੁਸ਼ ਹੋ ਕੇ ਭਾਗ ਲੈਂਦੇ ਨੇ ਭੰਗੜੇ ਦੀ ਟੀਮ ਦੇ ਵਿੱਚ ਪੰਜ ਸੱਤ ਨੌ ਜਾਂ ਗਿਆਰ੍ਹਾਂ ਬੰਦੇ ਭਾਗ ਲੈਂਦੇ ਨੇ ਜੋ ਭੰਗੜਾ ਪਾਉਂਦੇ ਨੇਗੇ ਭੰਗੜੇ ਦੀ ਉਹਨਾਂ ਦੀ ਡਰੈਸ ਕੁੜਤਾ ਚਾਦਰਾ ਪੱਗ ਹੁੰਦੀ ਹੈਗੀ ਪੰਜਾਬੀ ਜੁੱਤੀ ਹੈ ਉਹ ਹੁੰਦੀ ਹੈ ਜਿਹਦੇ ਨਾਲ ਪਾ ਕੇ ਬਹੁਤ ਸੋਹਣਾ ਰਹਿੰਦੇ ਨੇ ਹੱਥਾਂ ਵਿੱਚ ਸੰਮਾਂ ਵਾਲੀ ਡਾਂਗ ਹੁੰਦੀ ਹੈ ਜੋ ਫੜ ਕੇ ਉਹ ਭੰਗੜਾ ਪਾਉਂਦੇ ਨੇ ਪੰਜਾਬ ਦਾ ਹਰਮਨ ਪਿਆਰਾ ਭੰਗੜਾ ਹੈ ਜੀ ਵਿਆਹ ਹੋਵੇ ਸ਼ਾਦੀ ਹੋਵੇ ਕੋਈ ਲੋਹੜੀ ਦਾ ਤਿਉਹਾਰ ਹੋਵੇ ਭੰਗੜਾ ਪਾਇਆ ਜਾਂਦਾ ਜੀ ਵਿਆਹਾਂ ਦੇ ਵਿੱਚ ਚਾਹੇ ਕੁੜੀ ਦਾ ਵਿਆਹ ਮੁੰਡੇ ਦਾ ਵਿਆਹ ਚਾਹੇ ਜਾਗੋ ਕੱਢਣੀ ਜੀ ਭੰਗੜਾ ਜ਼ਰੂਰ ਪਾਇਆ ਜਾਂਦਾ ਹੈਗਾ ਭੰਗੜਾ ਪੰਜਾਬ ਦਾ ਪ੍ਰਮੁੱਖ ਤਿਉਹਾਰ ਹੈ ਜੀ ਭੰਗੜਾ ਵਿਸਾਖੀ ਦੇ ਟਾਈਮ 'ਤੇ ਪਾਇਆ ਜਾਂਦਾ ਜਦੋਂ ਕਿਸਾਨਾਂ ਦੀਆਂ ਫਸਲਾਂ ਵੱਢੀਆਂ ਜਾਂਦੀਆਂ ਨੇ ਖੁਸ਼ ਹੋ ਕੇ ਵਿਸਾਖੀ 'ਤੇ ਜਾਂਦੇ ਨੇ ਭੰਗੜਾ ਪਾਉਂਦੇ ਨੇ ਖੁਸ਼ੀ ਦੇ ਵਿੱਚ ਝੂਮਦੇ ਨੇਗੇ ਖੁਸ਼ੀ ਨਾਲ ਆਪਦੀ ਖੁਸ਼ੀ ਜ਼ਾਹਰ ਕਰਦੇ ਨੇ ਭੰਗੜੇ ਤੋਂ ਪਤਾ ਲੱਗਦਾ ਵੀ ਕਿਸਾਨ ਖੁਸ਼ ਹੈ ਕਿਸਾਨ ਦੀ ਫਸਲ ਵਧੀਆ ਹੋਈ ਹੈ ਇਸ ਕਰਕੇ ਉਹ ਭੰਗੜਾ ਪਾ ਰਿਹਾ ਹੈਗਾ ਭੰਗੜੇ ਦੇ ਨਾਲ ਸਰੀਰ ਦੀ ਮਾਨਸਿਕ ਸਥਿਤੀ ਵੀ ਠੀਕ ਰਹਿੰਦੀ ਹੈ ਜਦੋਂ ਭੰਗੜਾ ਪਾਉਂਦਾ ਜ਼ੋਰ ਲੱਗਦਾ ਬੰਦੇ ਦਾ ਭੰਗੜਾ ਹਰਮਨ ਪਿਆਰਾ ਪੰਜਾਬ ਦਾ ਸੰਗੀਤ ਵੀ ਹੈ ਸਾਰਾ ਕੁਛ ਹੀ ਹੈ ਜੀ ਭੰਗੜਾ ਭੰ ਪੰਜਾਬ ਵਾਸਤੇ ਭੰਗੜੇ ਤੋਂ ਬਿਨਾ ਕੋਈ ਵੀ ਤਿਉਹਾਰ ਕੋਈ ਵੀ ਵਿਆਹ ਸ਼ਾਦੀ ਸੋਹਣਾ ਨਹੀਂ ਲੱਗਦਾ ਜੇ ਭੰਗੜਾ ਪੰਜਾਬ ਦੇ ਲੋਕ ਨਾ ਪਾਉਣ ਤਾਂ ਭੰਗੜਾ ਸੱਭਿਅਤਾ ਪੰਜਾਬ ਦੀ